ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਤੁਹਾਡੇ ਬੱਚੇ ਵੀ ਕਿਹੜੇ ਸਕੂਲ 'ਚ ਪੜ੍ਹਦੇ ਹੈ ਹਾਂਜੀ ਮੈਂ ਕਿਹਾ ਅਸੀਂ ਵੀ ਆਪਣਾ ਬੇਟਾ ਲਗਾਉਣਾ ਹੈ ਅਤੇ ਵੀ ਸਾਨੂੰ ਵਧੀਆ ਜਿਹੇ ਕੋਈ ਸਕੂਲ ਦੱਸੋ ਵੀ ਕਿਹੜਾ ਵਧੀਆ ਜਿੱਥੇ ਪੜ੍ਹਾਈ ਵਧੀਆ ਹੋਵੇ ਹਾਂ ਹਾਂ ਹਾਂਜੀ ਹਾਂਜੀ ਹਾਂ ਸਾਨੂੰ ਵੀ ਹੈ ਵੀ ਦੱਸ ਦਿਓ ਨਾ ਫੀਸ ਵਗੈਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਸਕੂਲ ਕਿਹੜਾ ਵਧੀਆ ਅੱਛਾ ਖੇਡਾਂ ਖੁਡਾਂ ਵਿੱਚ ਵੀ ਬੱਚੇ ਨੂੰ ਲਉਣਾ ਹੋਵੇ ਹਾਂਜੀ ਹਾਂਜੀ ਤਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਤਾਂ ਐਂ ਹੀ ਆ ਵੀ ਹਾਂਜੀ ਸਾਨੂੰ ਤਾਂ ਐਂ ਆ ਵੀ ਬੱਚਾ ਵੀ ਸਕੂਲ ਵੀ ਵਧੀਆ ਹੋਵੇ ਅਤੇ ਵੀ ਚਲੋ ਐਡਮਿਸ਼ਨ ਵੀ ਠੀਕ ਠੀਕ ਹੋਵੇ ਹੈ ਨਾ ਫੀਸ ਵੀ ਚੱਲ ਹਾਂਜੀ ਹਾਂਜੀ ਹਾਂਜੀ ਅਤੇ ਵੀ ਊਂ ਵੀ ਆਪਣੇ ਮਤਲਬ ਪੰਜਾਬੀ ਮੀਡੀਅਮ ਹੋਵੇ ਜਿਹੜਾ ਬੱਚੇ ਨੂੰ ਹੈ ਨਾ ਆਪਣਾ ਅੱਜ ਕੱਲ੍ਹ ਦਾ ਹਾਂਜੀ ਮੈਂ ਕਿਹਾ ਪੰਜਾਬੀ ਵੀ ਚਾਹੀਦੀ ਹੈ ਨਾ ਨਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਤਾਂ ਐਂ ਆ ਵੀ ਬਸ ਬੱਚੇ ਵਧੀਆ ਸਕੂਲ 'ਚ ਵੀ ਪੜ੍ਹ ਜਾਣ ਕੋਈ ਨਾਲ ਖੇਡਾਂ ਦਾ ਵੀ ਹੋਵੇ ਹੈ ਨਾ ਅਤੇ ਵੀ ਹਾਂਜੀ ਹਾਂਜੀ ਠੀਕ ਹੈ ਹਾਂ ਠੀਕ ਹੈ ਮੈ ਠੀਕ ਹੈ ਸਤਿ ਸ਼੍ਰੀ ਅਕਾਲ